ਮੇਰੀਆਂ ਜ਼ਿਆਦਾਤਰ ਪਸੰਦੀਦਾ ਸ਼ੈਲੀਆਂ ਵਿਗਿਆਨ ਨਾਲ ਹੀ ਜੁੜੀਆਂ ਹਨ ਅਤੇ ਮੈਂ ਆਪਣੀ ਜ਼ਿੰਦਗੀ ਵਿੱਚ ਜ਼ਿਆਦਾਤਰ ਵਿਗਿਆਨ ਨਾਲ ਜੁੜੀਆਂ ਕਿਤਾਬਾਂ ਹੀ ਪੜ੍ਹੀਆਂ ਹਨ ਅਤੇ ਮੈਂ ਇਸ ਨੂੰ ਆਪਣੀ ਸਾਰੀ ਜ਼ਿੰਦਗੀ ਪੜ੍ਹ ਸਕਦਾ ਹਾਂ ਕਿਉਂਕਿ ਮੈਨੂੰ ਵਿਗਿਆਨ ਬਾਰੇ ਜਾਣਨਾ ਅਤੇ ਵਿਗਿਆਨ ਵਿੱਚ ਕਾਫੀ ਰੁਚੀ ਹੈ ਜਿਸ ਕਾਰਨ ਵਿਗਿਆਨ ਨਾਲ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ ਹੈ ਜੋ ਕਿ ਕਿਸੇ ਨੂੰ ਵੀ ਨਹੀਂ ਪਤਾ ਲੱਗਦਾ ਕਿ ਇਹ ਕਿਉਂ ਹੋ ਰਿਹਾ ਹੈ ਇਹਦਾ ਕੀ ਕਾਰਨ ਹੈ ਅਤੇ ਕਿਸੇ ਵੀ ਚੀਜ਼ ਸਾਡੀ ਦੁਨੀਆ ਵਿੱਚ ਹਰ ਇੱਕ ਚੀਜ਼ ਦੇ ਪਿੱਛੇ ਵਿਗਿਆਨ ਹੁੰਦੀ ਹੀ ਹੁੰਦੀ ਹੈ ਇਹੀ ਕਾਰਨ ਹੈ ਕਿ ਮੈਨੂੰ ਵਿਗਿਆਨ ਨਾਲ ਸੰਬੰਧਿਤ ਕਿਤਾਬਾਂ ਪੜ੍ਹਨ ਵਿੱਚ ਕਾਫੀ ਰੁਚੀ ਹੈ ਅਤੇ ਮੈਂ ਹਾਲ ਹੀ ਵਿੱਚ ਸਾਇੰਸ ਫਾਈਵ ਹੰਡਰਡ ਫੈਕਟਸ ਕਿਤਾਬ ਪੜ੍ਹੀ ਸੀ ਜਿਸ ਵਿੱਚ ਵਿਗਿਆਨ ਦੇ ਕਾਫੀ ਫੈਕਟਸ ਪ੍ਰਿੰਸੀਪਲਜ਼ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਹਰ ਇੱਕ ਚੀਜ਼ ਦੇ ਪਿੱਛੇ ਵਿਗਿਆਨ ਦਾ ਹੀ ਕਾਰਨ ਹੁੰਦਾ ਹੈ ਧੰਨਵਾਦ